ਹੈਲੋ ਹਾਂਜੀ ਫਰਨੀਚਰ ਸ਼ਾਪ ਤੋਂ ਬੋਲ ਰਹੇ ਹੋ ਤੁਸੀਂ ਅਸੀਂ ਨਾ ਫਰਨੀਚਰ ਲੈ ਕੇ ਗਏ ਸੀਗੇ ਤੇ ਸਾਨੂੰ ਉਹ ਫਿੱਟ ਨਹੀਂ ਹੈਗਾ ਵੀ ਅਸੀਂ ਵਾਪਸ ਕਰਨਾ ਅਸੀਂ ਅੱਜ ਤੋਂ ਵੀਹ ਬਾਈ ਦਿਨ ਪਹਿਲਾਂ

ਸਾਨੂੰ ਨਹੀਂ ਫਿੱਟ ਬੈਠਾ ਉਹ ਅੱਛਾ ਵਧੀਆ ਨਹੀਂ ਲੱਗਿਆ ਬੱਚਿਆਂ ਨੂੰ ਨਹੀਂ ਚੰਗਾ ਲੱਗਿਆ ਉਹ ਤਾਂ ਠੀਕ ਹ ਵੀ ਅਸੀਂ ਵਾਪਸ ਕਿਉਂ ਨਹੀਂ ਕਰ ਸਕਦੇ ਹੁਣ ਆਪਾਂ ਕੋਈ ਵੀ ਚੀਜ਼ ਲੈ ਕੇ ਆਉਂਦੇ ਆ ਤਾਂ ਵਾਪਸ ਕਰ ਹੀ ਸਕਦੇ ਆ ਇਹ ਤਾਂ ਸਾਰੇ ਹੀ ਹੈਗਾ ਵਾ ਕੌਣ ਨਹੀਂ ਕਹਿੰਦਾ ਨਹੀਂ ਕੋਈ ਤੁਹਾਡੇ ਵਾਂਗੂ ਤਾਂ ਵੀ ਐਨਾ ਰੂੜ ਵਿਹਾਰ ਕਰਦੇ ਹੋ ਤੁਸੀਂ ਵੀ ਨਹੀਂ ਲੈ ਸਕਦੇ ਅਸੀਂ

ਉਹ ਤੇ ਬਦਲੇ ਚ ਹੋਰ ਤਾਂ ਦੇ ਸਕਦੇ ਹੋ ਕੁਛ ਵੀ ਉਹ ਹੀ

ਹਾਂਜੀ ਹਾਂਜੀ ਹਾਂਜੀ ਹਾਂਜੀ ਰਸੀਦ ਹੈਗੀ ਹ ਸਾਡੇ ਕੋਲ ਰਸੀਦ ਹੈਗੀ ਆ ਨੀ ਰਸੀਦ ਹੈਗੀ ਆ ਸਾਡੇ ਕੋਲੇ ਸੀ ਤੇ ਲੈ ਕੇ ਆਵਾਂਗੇ ਹਾਂ ਸਾਡੇ ਕਲਰ ਵੀ ਨਹੀਂ ਪਸੰਦ ਆਇਆ ਬੱਚਿਆਂ ਨੂੰ ਤਾਂ ਡਿਜ਼ਾਇਨ ਵੀ ਨਹੀਂ ਅਸੀਂ ਦੋਨੋਂ ਹੀ ਲੈ ਕੇ ਗਏ ਸੀਗੇ ਪਹਿਲਾਂ ਤੇ ਪੈ ਪੈਸੇ ਵਾਪਸ ਕਰ ਦੋ ਤਾਂ ਫਿਰ ਵਧੀਆ ਰਹੂਗਾ ਕਿਉਂ ਕਾਰਨ ਇਹ ਤਾਂ ਗੱਲ ਗਲਤ ਫਿਰ ਅਸੀਂ ਗਾਹਾਂ ਕਿਵੇਂ ਤੁਹਾਡੀ ਸ਼ੌਪ ਤੇ ਆਵਾਂਗੇ ਕੋਈ ਚੀਜ਼ ਫਿਰ ਹੀ ਅਸੀਂ ਕਿੰਨੀਆਂ ਚੀਜ਼ਾਂ ਤਾਂ ਅਸੀਂ ਹੋਰ ਵੀ ਖਰੀਦਣੀਆਂ ਫਿਰ ਅਸੀਂ ਤੁਸੀਂ ਬਿਹਾਰ ਖਰਾਬ ਕਰ ਰਹੇ ਹੋ ਆਪਦਾ ਬਿੱਲ ਤੇ ਤੁਸੀਂ ਇਹ ਲਿਖਤਾ ਤੇ ਜਿਹੜੇ ਤੁਹਾਡੇ ਬੱਚੇ ਰੱਖੇ ਓ ਦੇਣ ਵਾਲੇ ਰੱਖੇ ਆ ਮੁੰਡੇ ਚਕਾਉਣ ਵਾਲੇ ਉਹ ਕਹਿ ਰਹੇ ਆ ਤੁਸੀਂ ਵਾਪਸ ਕਰ ਸਕਦੇ ਆ ਤੁਸੀਂ ਅੱਜ ਲੈ ਜਾਓ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਸਮੱਸਿਆ ਆਈ ਸਾਨੂੰ ਤੁਸੀਂ ਵਾਪਸ ਕਰ ਸਕਦੇ ਹੋ ਇਹ ਤਾਂ ਫਿਰ ਗਲਤ ਗੱਲ ਹੈ ਨਾ ਉਦਣ ਉਹ ਕਹਿ ਰਹੇ ਆ ਤੁਹਾਡੇ ਜਿਹੜੇ ਰੱਖੇ ਆ ਮੂਹਰੇ ਮੁੰਡੇ ਉਹ ਕਹਿ ਰਹੇ ਆ ਵੀ ਨਹੀਂ ਅਸੀਂ ਬਦਲ ਕੇ ਤੁਸੀਂ ਜੋ ਤੁਹਾਨੂੰ ਕੋਈ ਸਮੱਸਿਆ ਆਊਗੀ ਦੇਣ ਵੇਲੇ ਤੁਸੀਂ ਚੀਜ਼ ਕੋਈ ਹੋਰ ਲਿਜਾ ਮੁੜ ਕੇ ਵਾਪਸ ਕਰਨ ਵੇਲੇ ਕੋਈ ਹੋਰ ਇਹ ਤਾਂ ਗੱਲ ਗਲਤ ਹੈ ਨਹੀਂ ਅਸੀਂ ਪੈਸੇ ਤਾਂ ਨਹੀਂ ਦੇਣੇ ਹੁਣ ਸਾਨੂੰ ਉਹ ਵੀ ਤਾਂ ਖਰਚਾ ਪਿਆ ਜਿਹੜਾ ਅਸੀਂ ਲੈ ਕੇ ਗਏ ਉਹ ਵੀ ਸਾਨੂੰ ਖਰਚਾ ਪਊਗਾ ਇਹ ਵੀ ਜੇ ਵੀ ਅਸੀਂ ਗਲਤ ਲਾਵਾਂਗੇ ਇਹ ਤਾਂ ਫਿਰ ਗਲਤ ਹੈ ਨਾ ਸਾਡੇ ਵਾਸਤੇ ਠੀਕ ਹੈ ਜੀ ਠੀਕ ਫਿਰ ਅਸੀਂ ਬਦਲ ਕੇ ਲੈ ਕੇ ਜਾਵਾਂਗੇ ਫਿਰ ਤੁਸੀਂ ਠੀਕ ਐ ਓਕੇ